ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਸਿਹਤ ਦੀ ਸੰਭਾਲ ਦੀ ਗੁਣਵੱਤਾ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਪੰਜਾਬ ਦੇ ਲੋਕ ਸਿਹਤ ਦੀ ਸੰਭਾਲ ਲਈ ਕੈਮੀਕਲ ਤੋਂ ਬਣੀਆਂ ਦਵਾਈਆਂ ਦੀ ਵਰਤੋਂ ਘੱਟ ਵੱਧ ਹੀ ਕਰਦੇ ਹਨ ਉਹ ਘਰੇਲੂ ਨੁਸਖਿਆਂ ਨਾਲ ਹੀ ਸਿਹਤ ਦੀ ਸੰਭਾਲ ਕਰਦੇ ਹਨ ਜਿਵੇਂ ਕਿ ਸਾਨੂੰ ਸਰਦੀਆਂ ਵਿੱਚ ਖਾਂਸੀ ਜ਼ੁਕਾਮ ਹੋ ਜਾਂਦਾ ਹੈ ਤਾਂ ਮੇਰੇ ਮਾਤਾ ਜੀ ਘਰ ਵਿੱਚ ਹੀ ਇੱਕ ਕਾੜਾ ਬਣਾਉਂਦੇ ਹਨ ਜਿਸ ਨਾਲ ਅਸੀਂ ਠੀਕ ਹੋ ਜਾਂਦੇ ਹਾਂ ਉਸ ਕਾੜੇ ਨੂੰ ਗਰਮ ਪਾਣੀ ਵਿੱਚ ਮੁਲੱਠੀ ਕਾਲੀ ਮਿਰਚ ਨਮਕ ਅਜਵੈਣ ਸੌਫ਼ ਨੂੰ ਸਾਰੀਆਂ ਪਦਾਰਥਾਂ ਨੂੰ ਰਿੰਨ ਕੇ ਚੰਗੀ ਤਰ੍ਹਾਂ ਅਤੇ ਉਹਨਾਂ ਨੂੰ ਛਾਣ ਲਿੱਤਾ ਜਾਂਦਾ ਹੈ ਉਹ ਕਾੜਾ ਬਹੁਤ ਹੀ ਗੁਣਕਾਰੀ ਹੁੰਦਾ ਹੈ ਉਸ ਦੇ ਨਾਲ ਸਾਡਾ ਖਾਂਸੀ ਜ਼ੁਕਾਮ ਠੀਕ ਹੋ ਜਾਂਦਾ ਹੈ ਅਤੇ ਸਾਨੂੰ ਕੈਮੀਕਲ ਤੋਂ ਬਣੀਆ ਦਵਾਈਆਂ ਦੀ ਵੀ ਲੋੜ ਨਹੀਂ ਪੈਂਦੀ ਔਰ ਬੁਖਾਰ ਲਈ ਕਈ ਵਾਰ ਮੇਰੇ ਮਾਤਾ ਜੀ ਤੁਲਸੀ ਦੀ ਚਾਹ ਬਣਾ ਕੇ ਪਿਲਾਉਂਦੇ ਹਨ ਜੋ ਕਿ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀ ਹੈ ਸਾਡੀ ਸਿਹਤ ਲਈ ਤੁਲਸੀ ਇੱਕ ਪ੍ਰਕਾਰ ਦਾ ਪੌਦਾ ਹੈ ਜੋ ਕਿ ਬਹੁਤ ਹੀ ਲਾਭਦਾਇਕ ਹੈ ਉਸ ਦੇ ਵਿਚਲੇ ਗੁਣ ਸਾਡੀ ਸਿਹਤ ਨੂੰ ਠੀਕ ਰੱਖਦੇ ਹਨ ਅਤੇ ਸਾਨੂੰ ਤੰਦਰੁਸਤ ਰੱਖਦੇ ਹਨ ਇਸ ਨਾਲ ਕਈ ਬਿਮਾਰੀਆਂ ਦਾ ਨਾਸ਼ ਹੁੰਦਾ ਹੈ ਇਹ ਸਾਡੇ ਸਰੀਰ ਨੂੰ ਅੰਦਰੋਂ ਬਹੁਤ ਜ਼ਿਆਦਾ ਤੰਦਰੁਸਤ ਕਰ ਦਿੰਦੇ ਹਨ ਇਹਨਾਂ ਨਾਲ ਸਾਡੇ ਸਰੀਰ ਦੇ ਵਿਚਲੇ ਪਦਾਰਥ ਪਸੀਨੇ ਰਾਹੀਂ ਨਿਕਲ ਜਾਂਦੇ ਹਨ ਅਸੀਂ ਸਰਦੀਆਂ ਵਿੱਚ ਹਮੇਸ਼ਾ ਹੀ ਉਸ ਕਾੜੇ ਦੀ ਵਰਤੋਂ ਕਰਦੇ ਹਾਂ ਅਤੇ ਫਿਰ ਮਾਤਾ ਜੀ ਸਾਨੂੰ ਸੁਲਾ ਦਿੰਦੇ ਹਨ ਜਿਸ ਨਾਲ ਸਾਡੇ ਸਰੀਰ ਵਿੱਚ ਗਰਮਾਇਸ਼ ਨਾਲ ਸਾਰੇ ਪਸੀਨੇ ਦੇ ਰਾਹੀਂ ਜਿੰਨੇ ਵੀ ਸਾਡੇ ਸਰੀਰ ਵਿੱਚ ਜਹਿਰੀਲੇ ਪਦਾਰਥ ਹੁੰਦੇ ਹਨ ਜਿਹਨਾਂ ਨਾਲ ਅਸੀਂ ਬਿਮਾਰ ਹੁੰਦੇ ਹਾਂ ਉਹ ਸਾਰੇ ਨਿਕਲ ਜਾਂਦੇ ਹਨ ਤਾਂ ਅਸੀਂ ਤੰਦਰੁਸਤ ਹੋ ਜਾਂਦੇ ਹਾਂ ਇਸ ਕਰਕੇ ਪੰਜਾਬ ਵਿੱਚ ਸਿਹਤ ਦੀ ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਕਿਉਂਕਿ ਘਰੇਲੂ ਨੁਸਖਿਆਂ ਨਾਲ ਬਣੇ ਪਦਾਰਥਾਂ ਤੋਂ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਜਦੋਂ ਕਿ ਕੈਮੀਕਲ ਤੋਂ ਬਣੀਆਂ ਦਵਾਈਆਂ ਦੇ ਕਾਫੀ ਜ਼ਿਆਦਾ ਸਾਈਡ ਇਫੈਕਟ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਧੰਨਵਾਦ